ਤੇਰਾਂ ਜਨਵਰੀ ਦੋ ਹਜ਼ਾਰ ਤਿੰਨ ਦਸੰਬਰ ਦੋ ਹਜ਼ਾਰ ਦਸ ਚਾਰ ਅਪ੍ਰੈਲ ਦੋ ਹਜ਼ਾਰ ਇੱਕੀ ਚਾਰ ਨਵੰਬਰ ਉੱਨੀ ਸੌ ਨੜਿਨਵੇਂ ਬਾਰਾਂ ਮਈ ਉੱਨੀ ਸੌ ਪਚਾਨਵੇਂ